ਹੈਲੋ ਸਤਿ ਸ਼੍ਰੀ ਅਕਾਲ ਜੀ ਮੈਂ ਕੁਲਵਿੰਦਰ ਕੌਰ ਗੁਰਦਾਸਪੁਰ ਸ਼ਹਿਰ ਤੋਂ ਬੋਲ ਰਹੀ ਹਾਂ ਜਿਸ ਤਰ੍ਹਾਂ ਤੁਸੀਂ ਪੁਛਿਆਂ ਕਿ ਤੁਹਾਨੂੰ ਕਦੇ ਉਚਾਈਆਂ ਤੋਂ ਡਰ ਲੱਗਾ ਉਚਾਈਆਂ ਬਾਰੇ ਕੀ ਅਸੀਂ ਤੁਹਾਨੂੰ ਉਚਾਈਆਂ ਤੋਂ ਕਦੀ ਵੀ ਡਰ ਨਹੀਂ ਲੱਗਿਆ ਇਸ ਤਰ੍ਹਾਂ ਜਿਸ ਕਰਕੇ ਅਸੀਂ ਵੈਸ਼ਨੋ ਮਾਤਾ ਦੇ ਜਾਈਏ ਉੱਥੇ ਬਹੁਤ ਜ਼ਿਆਦਾ ਉਚਾਈ ਹੁੰਦੀ ਹੈ ਚੜ੍ਹਾਈ ਹੁੰਦੀ ਆ ਜਿਸ ਤਰ੍ਹਾਂ ਕਿ ਪਹਾੜਾਂ 'ਤੇ ਚੜ੍ਹਨਾ ਫਿਰ ਅਸੀਂ ਵੈਸ਼ਨੋ ਦੇਵੀ ਇਸ ਤਰ੍ਹਾਂ ਬਹੁਤ ਜਗ੍ਹਾ 'ਤੇ ਅਸੀਂ ਘੁੰਮਣ ਵਾਸਤੇ ਗਏ ਸਾਨੂੰ ਕਦੀ ਵੀ ਉਚਾਈਆਂ ਤੋਂ ਡਰ ਨਹੀਂ ਲੱਗਿਆ ਅਸੀਂ ਬਸ ਵਿਚ ਸਫਰ ਕੀਤਾ ਉਚਾਈਆਂ 'ਤੇ ਪੈਦਲ ਯਾਤਰਾ ਵੀ ਅਸੀਂ ਉਚਾਈਆਂ 'ਤੇ ਕੀਤੀ ਬਹੁਤ ਵਧੀਆ ਲੱਗਿਆ ਜੇ ਕਦੀ ਥਕਾਵਟ ਹੁੰਦੀ ਅਸੀਂ ਬੈਠ ਕੇ ਰੈਸਟ ਕਰ ਲੈਣੀ ਖਾ ਪੀ ਲੈਣਾ ਕੁਝ ਫਿਰ ਅਸੀਂ ਚਲਦੇ ਤੁਰ ਪੈਣਾ ਕਦੀ ਵੀ ਸਾਡੇ ਬੱਚਿਆਂ ਨੂੰ ਵੀ ਕਦੀ ਉਚਾਈਆਂ ਤੋਂ ਡਰ ਨਹੀਂ ਲੱਗਿਆ ਹੈਗਾ ਇਸ ਲਈ ਸਾਨੂੰ ਉਚਾਈ ਤੋਂ ਕਦੇ ਵੀ ਡਰ ਨਹੀਂ ਲੱਗਿਆ ਹੈਗਾ ਅਸੀਂ ਹਮੇਸ਼ਾ ਹੀ ਡਰ ਨੂੰ ਦੂਰ ਕੀਤਾ ਹੈ ਔਰ ਬਹੁਤ ਵਧੀਆ ਲੱਗਦਾ ਹੈ ਇੰਜੋਏ ਕੀਤਾ ਅਸੀਂ ਪਹਾੜਾਂ 'ਤੇ ਚੜ੍ਹਨ ਵਾਸਤੇ ਅਸੀਂ ਫੋਟੋਆਂ ਵਗੈਰਾ ਵੀ ਖਿਚਾਉਂਦੇ ਰਹੇ ਹਾਂ ਔਰ ਸੈਲਫੀ ਵਗੈਰਾ ਵੀ ਲੈਂਦੇ ਰਹੇ ਬੱਚੇ ਵੀ ਖੂਬ ਇੰਜੋਏ ਕਰਦੇ ਰਹੇ ਅਸੀਂ ਓਕੇ ਥੈਂਕ ਯੂ